ਸਮੇਂ ਦੇ ਨਾਲ ਨਾਲ ਪੰਜਾਬ ਦੇ ਸੱਭਿਆਚਾਰਕ ਅਤੇ ਕਲਾਤਮਿਕ ਵਿਰਾਸਤ ਕਾਫੀ ਬਦਲ ਚੁੱਕੀ ਆ ਪਹਿਲਾਂ ਜੋ ਕਿ ਖੇਤੀ ਹੁੰਦੀ ਸੀ ਉਹ ਹੱਲ ਅਤੇ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ ਜਿਹੜੀ ਕਿ ਹੁਣ ਹੁਣ ਕੀਤੀ ਜਾਂਦੀ ਹੈ ਟਰੈਕਟਰਾਂ ਦੇ ਨਾਲ ਔਰ ਬਾਕੀ ਸੱਭਿਆਚਾਰ ਦੀ ਗੱਲ ਕਰੀਏ ਅਤੇ ਸਾਡਾ ਪਹਿਰਾਵਾ ਉਹ ਵੀ ਹੁਣ ਬਦਲ ਚੁੱਕਾ ਆ ਕਲਾਤਮਿਕ ਜਿਹੜਾ ਸਾਡਾ ਵਿਰਾਸਤ ਆ ਸਾਡੀਆਂ ਜਿਵੇਂ ਕਿਲਾ ਮੁਬਾਰਕ ਕੈਪਟਨ ਅਮਰਿੰਦਰ ਸਿੰਘ ਜੀ ਰਾਜਿਆਂ ਦੀ ਫੈਮਲੀ ਦੇ ਵਿੱਚੋਂ ਹਨ ਉਹ ਉੱਥੇ ਰਹਿੰਦੇ ਹਨ ਜੋ ਕਿ ਪਟਿਆਲੇ ਦੇ ਵਿੱਚ ਹੈ ਉਹ ਵੀ ਕਾਫੀ ਪ ਵਿਰਾਸਤ ਉਹਨਾਂ ਨੇ ਸੰਭਾਲ ਕੇ ਰੱਖੀ ਹੋਈ ਆ ਉਸ ਦੇ ਵਿੱਚ ਇੱਕ ਮਿਊਜ਼ੀਅਮ ਵੀ ਹੈ ਜੋ ਕਿ ਲੋਕ ਬਹੁਤ ਸਾਰੇ ਦੇਖਣ ਜਾਂਦੇ ਹਨ ਇਹ ਸਾਡੀ ਸੱਭਿਆਚਾਰਕ ਅਤੇ ਕਲਾਤਮਿਕ ਵਿਰਾਸਤ ਹੈ ਜੋ ਕਿ ਉਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ